ਮੈਂ ਪੰਜਾਬ ਦੀ ਰਹਿਣ ਦੀ ਵਾਸੀ ਹਾਂ ਅਤੇ ਪੰਜਾਬ ਦਾ ਜਿਹੜਾ ਮੁੱਖ ਉਦਯੋਗ ਹੈ ਉਹ ਖੇਤੀਬਾੜੀ ਹੈ ਜਿਹੜੇ ਕਿਸਾਨ ਨੇ ਉਹ ਫ਼ਸਲਾਂ ਬੀਜਦੇ ਨੇ ਸਬਜ਼ੀਆਂ ਨੂੰ ਉਗਾਉਂਦੇ ਨੇ ਅਤੇ ਬਾਅਦ ਵਿੱਚ ਆਪਣਾ ਰੁਜ਼ਗਾਰ ਚਲਾਉਣ ਲਈ ਇਹ ਸਬਜ਼ੀਆਂ ਅਤੇ ਫ਼ਸਲਾਂ ਮੰਡੀ ਵਿੱਚ ਵੇਚ ਦਿੰਦੇ ਨੇ ਅਤੇ ਉਸ ਦੇ ਨਾਲ ਪੈਸੇ ਕਮਾਉਂਦੇ ਨੇ ਪਰ ਕਈ ਲੋਕ ਹੁਣ ਕਿਸਾਨੀ ਛੱਡ ਕੇ ਦੂਜੇ ਕੰਮਾਂ ਵਿੱਚ ਪੈ ਗਏ ਨੇ ਜਿਵੇਂ ਕਿ ਪੋਲਟਰੀ ਫਾਰਮ ਆਪਣਾ ਖੋਲ੍ਹਣ ਲੱਗ ਗਏ ਨੇ ਅਤੇ ਡੇਅਰੀ ਆਪਣੀ ਖੋਲ੍ਹਣ ਲੱਗ ਗਏ ਨੇ ਅਤੇ ਕਈ ਲੋਕ ਮੱਝਾਂ ਪਾਲਦੇ ਨੇ ਅਤੇ ਘਰ ਘਰ ਜਾ ਕੇ ਦੁੱਧ ਵੇਚਦੇ ਨੇ ਅਤੇ ਉਹਨਾਂ ਨੂੰ ਇਸ ਤੋਂ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਕਈ ਲੋਕ ਆਪਣੇ ਹੀ ਪੋਲਟਰੀ ਫਾਰਮ ਖੋਲ੍ਹਦੇ ਹਨ ਮੁਰਗੀਆਂ ਪਾਲ ਲੈਂਦੇ ਹਨ ਅਤੇ ਉਹਨਾਂ ਦੇ ਅੰਡਿਆਂ ਨੂੰ ਅੱਗੇ ਜਾ ਕੇ ਵੇਚਦੇ ਨੇ ਅਤੇ ਪ੍ਰੋਫਿਟ ਕਮਾਉਂਦੇ ਨੇ ਅਤੇ ਅੱਜ ਕੱਲ੍ਹ ਦੇ ਪੰਜਾਬ ਵਿੱਚ ਕਾਫ਼ੀ ਸਾਰੀਆਂ ਤਬਦੀਲੀਆਂ ਵੀ ਦੇਖਣ ਨੂੰ ਮਿਲਦੀਆਂ ਨੇ ਅਤੇ ਮੀਂਹ ਵਾਰ ਕਿਸਾਨਾਂ ਨੂੰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਮੀਂਹ ਪੈ ਜਾਣ ਕਰਕੇ ਇਹਨਾਂ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ ਜਿਸ ਕਾਰਨ ਅੱਗੇ ਇਹ ਵਧੀਆ ਦਾਮ 'ਤੇ ਵੀ ਨਹੀਂ ਵਿਕਦੀ ਅਤੇ ਇਹਨਾਂ ਨੂੰ ਉਸ ਨਾਲ ਕੋਈ ਲਾਭ ਨਹੀਂ ਹੁੰਦਾ ਹੈ ਅਤੇ ਨੁਕਸਾਨ ਹੁੰਦਾ ਪਰ ਸਰਕਾਰ ਨੇ ਇਹਨਾਂ ਨੂੰ ਕਾਫ਼ੀ ਸਾਰੇ ਲੋਨ ਲੋਨ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨਾਲ ਇਹਨਾਂ ਨੂੰ ਆਤਮ ਹੱਤਿਆ ਨਾ ਕਰਨੀ ਪਵੇ ਕਿਉਂਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਜਿਹੜੇ ਕਿਸਾਨ ਨੇ ਅ ਕਰਜ਼ੇ ਕਰਕੇ ਆਤਮਹੱਤਿਆ ਕਰ ਲੈਂਦੇ ਨੇ ਅਤੇ ਇਹ ਚੀਜ਼ਾਂ ਨੂੰ ਰੋਕਣ ਲਈ ਵੀ ਸਰਕਾਰ ਨੇ ਕਿਸਾਨਾਂ ਨੂੰ ਲੋਨ ਦੇਣਾ ਸ਼ੁਰੂ ਕੀਤਾ ਹੈ ਜਿਸ ਕਾਰਨ ਇਹ ਜਿਹੜੀ ਆਤਮਹੱਤਿਆ ਸੁਸਾਈਡ ਇਹ ਰੁਕ ਜਾਵੇ